ਹਾਂਜੀ ਮੈਂ ਬਿਜਲੀ ਦੇ ਖਤਰਿਆਂ ਤੋਂ ਜਾਣੂ ਹਾਂ ਬਿਜਲੀ ਹੈਗੀ ਤਾਂ ਸਾਡੇ ਲਈ ਇੱਕ ਵਧੀਆ ਹੈ ਪਰ ਇਹਦੇ ਬਹੁਤ ਸਾਰਾ ਨੁਕਸਾਨ ਵੀ ਹਨ ਇਹਦੇ ਬਹੁਤ ਜ਼ਿਆਦਾ ਖਤਰੇ ਵੀ ਹਨ ਜਿੱਦਾਂ ਕਿ ਕਰੰਟ ਲੱਗਣਾ ਸ਼ੋਟ ਸਰਕਟ ਹੋਣਾ ਸ਼ੋਟ ਸਰਕਟ ਹੋ ਕੇ ਫਿਰ ਅੱਗ ਲੱਗਣਾ ਅਤੇ ਤਾਰਾਂ 'ਚ ਇੱਕ ਤਰ੍ਹਾਂ ਨਾਲ਼ ਚਿੜ ਚਿੜ ਚਿੜ ਦੀ ਆਵਾਜ਼ ਆਉਂਦੀ ਰਹਿਣਾ ਇਹ ਸਾਰੇ ਬਿਜਲੀ ਦੇ ਖਤਰੇ ਹਨ ਹੁਣ ਇੱਕ ਹ ਬਿਜਲੀ ਦਾ ਇੱਕ ਹੋਰ ਖਤਰੇ ਨੇ ਇੱਕ ਨਵਾਂ ਰੂਪ ਧਾਰਨ ਕਰ ਲਿਆ ਜਿੱਦਾਂ ਕਿ ਪਿੰਡਾਂ 'ਚ ਹੁੰਦਾ ਏ ਕਿ ਜਦੋਂ ਉਹ ਖੇਤ ਦੇ ਆਲ਼ੇ ਦੁਆਲ਼ੇ ਇੱਕ ਲੋਹੇ ਦੀ ਤਾਰ ਲਗਾ ਦਿੰਦੇ ਨੇ ਅਤੇ ਉਹਦੇ 'ਚ ਇੱਕ ਬਿਜਲੀ ਦਾ ਕਰੰਟ ਛੱਡ ਦਿੰਦੇ ਨੇ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਈ ਵਾਰ ਕਿਸੇ ਵਿਅਕਤੀ ਨੂੰ ਹੀ ਨਹੀਂ ਪਤਾ ਹੁੰਦਾ ਕਿ ਇਹਦੇ 'ਚ ਕਰੰਟ ਛੱਡਿਆ ਉਹ ਹੱਥ ਤੇ ਉਹਦੇ 'ਤੇ ਹੱਥ ਰੱਖ ਦਿੰਦਾ ਤਾਂ ਉਹ ਜਾਨ ਤੋਂ ਚਲਾ ਜਾਂਦਾ ਇਸ ਤਰ੍ਹਾਂ ਵਿਚਾਰੇ ਜਾਨਵਰ ਪੰਛੀ ਉਹਨਾਂ ਦਾ ਕੀ ਕਸੂਰ ਹੈ ਉਹ ਉਹਦੇ 'ਤੇ ਬਹਿ ਜਾਂਦੇ ਜਾਂ ਲੰਘਦੇ ਨੇ ਤਾਂ ਉਹਨਾਂ ਦਾ ਉਹ ਵੀ ਉੱਥੇ ਹੀ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਇਹ ਇੱਕ ਤਰ੍ਹਾਂ ਦਾ ਕਰਦੇ ਤਾਂ ਬਚਾਅ ਨੇ ਕਿ ਸਾਡੇ ਜਿਹੜੇ ਖੇਤਾਂ ਦੀ ਫਸਲ ਹੈ ਉਹ ਜਾਨਵਰਾਂ ਤੋਂ ਬਚ ਸਕੇ ਪਰ ਇਹਦੇ ਲਈ ਕੋਈ ਆਪਾਂ ਹੋਰ ਕੁਦਰਤੀ ਤਰੀਕਾ ਅਪਣਾ ਲਈਏ ਤਾਂ ਕਿ ਇਹਦੇ ਤੋਂ ਬਚਾ ਹੋ ਸਕੇ ਅਤੇ ਇਸ ਤਰ੍ਹਾਂ ਕਰੰਟ ਲੱਗਣਾ ਘਰ 'ਚ ਅਗਰ ਕੋਈ ਬਿ ਬਿਜਲੀ ਦੀ ਤਾਰ ਨੰਗੀ ਹੈ ਕੋਈ ਪਾਣੀ ਦੇ ਕੋਲ ਤਾਰ ਹੈ

ਕਿਸੇ ਜੇ ਕਿਸੇ ਹੋਰ ਦੇ ਘਰ 'ਚ ਵੀ ਦਿਖਦੀ ਤਾਂ ਉਹਨੂੰ ਦੱਸ ਦਿਉ ਰਸਤੇ 'ਚ ਦਿਖਦੀ ਤਾਂ ਵੀ ਦੱਸ ਦਿਉ ਅਤੇ ਜਿਹੜਾ ਆਹ ਇੱਕ ਅ ਤਾਰ ਲਗਾ ਕੇ ਉਹਦੇ 'ਚ ਕਰੰਟ ਛੱਡਣ ਲੱਗ ਗਏ ਉਹਦੇ 'ਤੇ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਦਾਂ ਜਿਹੜੇ ਬੇਜਵਾਨ ਪਸ਼ੂ ਅਤੇ ਪੰਛੀ ਹੈ ਉਹ ਵਿਚਾਰੇ ਮਰ ਰਹੇ ਹਨ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਏ ਜੀ